ਹੈਲੋ ਹਾਂਜੀ ਮੈਂ ਪੰਜਾਬ ਨਿਊਜ਼ ਚੈਨਲ ਤੋਂ ਬੋਲ ਰਹੀ ਹਾਂ ਹਾਂਜੀ ਮੈਂ ਨਾ ਇੱਥੇ ਆਪਣੇ ਤੁਹਾਡੇ ਏਰੀਏ ਦੇ ਵਿੱਚ ਇੱਕ ਜਿਹੜਾ ਸਿੰਗਰ ਹੈ ਸਿੱਧੂ ਮੂਸੇਵਾਲਾ ਉਹਦੇ ਬਾਰੇ ਸੁਣਿਆ ਕਾਫ਼ੀ ਮਤਲਬ ਕਿ ਉਹਨੇ ਆਪਣੀ ਮਹਾਨਤਾ ਹਾਸਿਲ ਕਰ ਲਈ ਹੈ ਲੋਕ ਉਹਨੂੰ ਬਹੁਤ ਪਸੰਦ ਕਰਦੇ ਨੇ ਜਿ ਜਿੱਥੇ ਮਰਜ਼ੀ ਦੇਖੋ ਉਹਦੀ ਫੋਟੋ ਲੱਗੀ ਆ ਜਿਵੇਂ ਹੁਣ ਟੀਸ਼ਰਟਾਂ ਦੇ ਇੱਕ ਤਰ੍ਹਾਂ ਦਾ ਬਹੁਤ ਵੱਡਾ ਹਾਈ ਬ੍ਰੈਂਡ ਬਣ ਗਿਆ ਉਹ ਮੈਨੂੰ ਉਹਦੇ ਬਾਰੇ ਕੁਛ ਦੱਸ ਸਕਦੇ ਹੋ ਤੁਸੀਂ ਮੈਨੂੰ ਚੰਗੀ ਤਰ੍ਹਾਂ ਮਤਲਬ ਕਿ ਖੁੱਲ੍ਹ ਕੇ ਜਾਣਕਾਰੀ ਚਾਹੀਦੀ ਆ ਮੈਨੂੰ ਉਹਦੇ ਬਾਰੇ

ਅੱਛਾ

ਠੀਕ ਹੈ ਜੀ

ਅੱਛਾ ਅੱਛਾ ਅੱਛਾ ਅੱਛਾ ਅੱਛਾ ਅੱਛਾ ਚਲੋ ਹਾਂਜੀ ਚਲੋ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਇੰਨੀ ਜਾਣਕਾਰੀ ਮੈਨੂੰ ਬਹੁਤ ਹੈ ਆਪਣੇ ਨਿਊਜ਼ ਚੈਨਲ 'ਤੇ ਪਾਉਣ ਲਈ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਚੰਗਾ ਜੀ ਠੀਕ ਹੈ ਜੀ ਓਕੇ ਜੀ ਸ਼ੁਕਰੀਆ ਜੀ ਠੀਕ ਹੈ ਜੀ ਸ਼ੁਕਰੀਆ ਜੀ